ਮੋਬਾਈਲ ਗੇਮਿੰਗ ਦਾ ਰੁਝਾਨ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਇਸ ਨੇ ਬੱਚੇ ਬੜੇ ਬੁੜੇ ਸਭ ਨੂੰ ਆਪਣੇ ਜਾਲ ਵਿੱਚ ਲੈ ਲਿਆ ਹੈ ਮੋਬਾਈਲ ਗੇਮਿੰਗ ਦੇ ਆਉਣ ਨਾਲ ਵਧੀਆ ਪ੍ਰੋਸੈਸਰ ਵਾਲੇ ਮੋਬਾਈਲ ਫੋਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ ਬੱਚੇ ਜ਼ਿਆਦਾਤਰ ਉਹੀ ਫੋਨ ਖਰੀਦਦੇ ਹਨ ਜਿਨ੍ਹਾਂ ਵਿੱਚ ਉਹ ਗੇਮ ਨੂੰ ਆਸਾਨੀ ਗੈਲ ਖੇਡ ਸਕਣ ਇਸ ਦੇ ਵਿਰੁੱਧ ਸਪੋਰਟਸ ਇੰਡਸਟਰੀ ਵੀ ਇਸ ਦੇ ਗੈਲ ਪ੍ਰਭਾਵਿਤ ਹੋਈ ਹੈ ਜਿਵੇਂ ਕਿ ਕ੍ਰਿਕਟ ਦਾ ਸਮਾਨ ਫੁੱਟਬਾਲ ਦਾ ਸਮਾਨ ਇਵੇਂ ਦੀਆਂ ਚੀਜ਼ਾਂ ਅੱਜ ਕੱਲ ਇਨ੍ਹਾਂ ਦੀ ਇਕਵੀਪਮੈਂਟ ਦੀ ਖਰੀਦ ਵਿੱਚ ਭਾਰੀ ਗਿਰਾਵਟ ਆਈ ਹੈ ਜ਼ਿਆਦਾਤਰ ਬੱਚੇ ਘਰ ਬੈਠ ਕੇ ਔਨਲਾਈਨ ਗੇਮਾਂ ਖੇਡਣ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਬਾਹਰ ਜਾ ਕੇ ਗਰਾਉਂਡ ਵਿੱਚ ਫਿਜਿਕਲੀ ਜਾ ਕੇ ਕੋਈ ਵੀ ਗੇਮ ਨਹੀਂ ਖੇਡਦੇ